ਪੰਜ ਲੱਖ ਛੇ ਹਜ਼ਾਰ ਨੌ ਸੌ ਤਰੇਂਹਠ ਛੇ ਹਜ਼ਾਰ ਛੇ ਸੌ ਬਵੰਜਾ ਤੇਹੱਤਰ ਲੱਖ ਨੱਬੇ ਹਜ਼ਾਰ ਤਿੰਨ ਸੌ ਇੱਕਾਹਠ ਤਰਵੰਜਾ ਹਜ਼ਾਰ ਪੰਜ ਸੌ ਬੱਤੀ ਦਸ ਹਜ਼ਾਰ ਨੌ ਸੌ ਤਰੇਂਹਠ